ਮੈਨੂੰ ਲੱਗਦਾ ਹੈ ਕਿ ਸਕੂਲਾਂ ਵਿੱਚ ਵਧੇਰੇ ਕਿੱਤਾ ਮੁਖੀ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਕਈ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਜੋ ਪਿਛੋਕੜ ਹੈ ਜਾਂ ਜਿਨ੍ਹਾਂ ਦਾ ਪਰਿਵਾਰ ਹੈ ਉਸ ਉਸ ਨਾਲ ਮਤਲਬ ਕਿ ਜੇ ਕੋਈ ਤਰਖਾਣ ਹੈ ਅਤੇ ਉਸ ਨਾਲ ਉਹ ਸਬੰਧ ਰੱਖਦਾ ਹੈ ਅਤੇ ਉਹ ਚਾਹੁੰਦਾ ਕਿ ਅੱਗੇ ਉਹ ਉਹ ਹੀ ਕੰਮ ਕਰੇ ਪਲੰਬਿੰਗ ਹੋ ਗਈ ਸਿਲਾਈ ਹੋ ਗਈ ਕਈ ਕੁੜੀਆਂ ਹਨ ਜੋ ਜ਼ਿਆਦਾ ਪੜ੍ਹ ਲਿਖ ਨਹੀਂ ਸਕਦੀਆਂ ਅਗਰ ਉਹਨਾਂ ਨੂੰ ਸਿਲਾਈ ਦਾ ਕਿੱਤਾ ਦਿੱਤਾ ਜਾਵੇ ਤਾਂ ਉਹਨਾਂ ਲਈ ਉਹ ਬਹੁਤ ਹੀ ਜ਼ਿਆਦਾ ਲਾਭਦਾਇਕ ਹੋ ਸਕਦਾ ਹੈ ਉਹਨਾਂ ਲਈ ਇੱਕ ਕਮਾਈ ਦਾ ਸਾਧਨ ਬਣ ਸਕਦਾ ਹੈ